ਹੈਲੋ ਹੈਲੋ ਹੈਲੋ ਹਾਂਜੀ ਨਮਸਤੇ ਹੈਲੋ ਹਾਂਜੀ ਨਮਸਤੇ ਸਰ ਮੈਂ ਮੈਂ ਨਾ ਫੂਡ ਵਲੋਗਰ ਹਾਂ ਮੈਨੂੰ ਕੋਈ ਤੁਸੀਂ ਦੱਸੋ ਮੈਂ ਚੰਡੀਗੜ੍ਹ ਤੋਂ ਆਈ ਹਾਂ ਹੁਸ਼ਿਆਰਪੁਰ ਵਿੱਚ ਮੈਨੂੰ ਦੱਸਿਓ ਕੋਈ ਵਧੀਆ ਰੈਸਟੋਰੈਂਟ ਕੋਈ ਹੋਟਲ ਵਧੀਆ ਮੈਨੂੰ ਦੱਸਿਓ ਕਿੱਥੇ ਵਧੀਆ ਸਾਨੂੰ ਫੂਡ ਮਿਲ ਸਕਦਾ ਬਰਡੇ ਪਾਰਟੀ ਲਈ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਮਤਲਬ ਕਿ ਹਰ ਵਰੈਟੀ ਸਾਨੂੰ ਮਿਲ ਸਕਦੀ ਹੈ ਇੱਕ ਥਾਂ ਤੋਂ ਹੀ ਅੱਛਾ ਜੀ ਹਾਂਜੀ ਹਾਂਜੀ ਓਕੇ ਰੇਟ ਰੇਟ ਮੈਕਸੀਮਮ ਰੇਟ ਨਾ ਅੱਛਾ ਅੱਛਾ ਜੀ ਠੀਕ ਆ ਅੱਛਾ ਜੀ ਹਾਂਜੀ ਹਾਂ ਮਨਚੂਰੀਅਨ ਚਾਂਪਾਂ ਹਾਂਜੀ ਅੱਛਾ ਅੱਛਾ ਜੀ ਨਿਊਟਰੀ ਕੁਲਚੇ ਅੱਛਾ ਜੀ ਓਕੇ ਹਾਂਜੀ ਅੱਛਾ ਜੀ ਨਹੀਂ ਸਰ ਜੇ ਬਰਡੇ ਪਾਰਟੀ ਲਈ ਜਾਂ ਮੈਰਿਜ ਰਿਸ਼ੈਪਸ਼ਨ ਲਈ ਅੱਛਾ ਜੀ ਮੈਰਿਜ ਰਿਸ਼ੈਪਸ਼ਨ ਲਈ ਜਾਂ ਕੋਈ ਰਿਸੈਪਸ਼ਨ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂ ਠੀਕ ਆ ਅੱਛਾ ਅੱਛਾ ਜੀ ਨੋਨ ਵੈਜ ਵੈਜ ਸਾਰੇ ਹੀ ਦਸ ਦਿੰਦੇ ਉੱਥੇ ਆ

ਅੱਛਾ ਜੀ ਬਰਗਰ ਪੀਜ਼ਾ ਵੈਗਰਾ ਇੱਦਾਂ ਦਾ ਕੁਛ ਮਿਲ ਜਾਂਦਾ ਉੱਥੇ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਨਹੀਂ ਉਹਦੇ ਵਿੱਚ ਸਾਨੂੰ ਖਾਣਾ ਚਾਵਲ ਵਗੈਰਾ ਸਾਰਾ ਕੁਛ ਦੋ ਤਿੰਨ ਤਰ੍ਹਾਂ ਦੀ ਵਰੈਟੀ ਨਾਲ ਸਬਜ਼ੀ ਸਾਰਾ ਕੁਛ ਮਿਲ ਸਕਦੀਆਂ ਅੱਛਾ ਜੀ ਠੀਕ ਹੈ ਅੱਛਾ ਠੀਕ ਹੈ ਸਰ ਓਕੇ ਥੈਂਕ ਯੂ